ਹਾਂਜੀ ਮੇਰੇ ਕੋਲ ਸਿਹਤ ਸੰਭਾਲ ਬੀਮਾ ਹੈ ਅਤੇ ਇਹ ਮੈਂ ਐੱਲ ਆਈ ਸੀ ਤੋਂ ਕਰਵਾਇਆ ਹੋਇਆ ਹੈ ਅਤੇ ਆਪਣੇ ਪਰਿਵਾਰਿਕ ਮੈਂਬਰਾਂ ਲਈ ਵੀ ਵਰਤਿਆ ਹੈ